ਮੈਂ ਸਭ ਤੋਂ ਵੱਧ ਵਿਦੇਸ਼ੀ ਚੀਜ਼ਾਂ ਦਾ ਇਸਤੇਮਾਲ ਨਿਊਡਲ ਬਣਾਉਣ ਦੇ ਵਿੱਚ ਕਰਦੀ ਹਾਂ ਨਿਊਡਲ ਬਣਾਉਣ ਲੱਗੇ ਮੈਂ ਉਹਨਾਂ ਵਿੱਚ ਪਹਿਲਾਂ ਸੋਇਆ ਸੋਸ ਟਮਾਟੋ ਸੋਸ ਚਿੱਲੀ ਸੋਸ ਵਗੈਰਾ ਪਾਉਂਦੀ ਹਾਂ ਅਤੇ ਉਹਨਾਂ ਦੀ ਸੀਜ਼ਿੰਗ ਸੀਜ਼ਨਿੰਗ ਜਿਹਦੇ ਲਈ ਮੈਂ ਅਜੀਨੋਮੋਟੋ ਚਿੱਲੀ ਫਲੇਸ ਸੋਇਆ ਸੋਸ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਵਿਦੇਸ਼ੀਆਂ ਚੀਜ਼ਾਂ ਪੈਂਦੀਆਂ ਹਨ ਅਤੇ ਉਹਦੇ ਨਾਲ ਹੀ ਇਹ ਨੂਡਲ ਵਗੈਰਾ ਬਣਦੇ ਹਨ ਬਰਗਰ ਪੀਜ਼ਾ ਇਹਨਾਂ ਚੀਜ਼ਾਂ ਦੇ ਲਈ ਵੀ ਟਮਾਟੋ ਸੋਰਸ ਸੋਇਆ ਸੋਸ ਚਿੱਲੀ ਸੋਸ ਅਤੇ ਸੀਜ਼ਨਿੰਗ ਵਗੈਰਾ ਲਈ ਹੀ ਚਿੱਲੀ ਫਲੇਕਸ ਪੈਂਦੇ ਹਨ ਅਜੀਨੋਮੋਟੋ ਪੈਂਦੀ ਹੈ ਅਤੇ ਇਹਨਾਂ ਚੀਜ਼ਾਂ ਤੋਂ ਬਗੈਰ ਇਹਨਾਂ ਦਾ ਸਵਾਦ ਵੀ ਨਹੀਂ ਆਉਂਦਾ ਹੈ ਅਤੇ ਮੈਂ ਨਿਊਡਲ ਬਣਾਉਣ ਦੇ ਲਈ ਵੀ ਹੀ ਇਹਨਾਂ ਹੀ ਚੀਜ਼ਾਂ ਦਾ ਇਸਤੇਮਾਲ ਕੀਤਾ ਅਤੇ ਇਹਨਾਂ ਚੀਜ਼ਾਂ ਦਾ ਹੀ ਇਸਤੇਮਾਲ ਕਰਨ ਦੇ ਨਾਲ ਇੱਕ ਤਾਂ ਇਹਨਾਂ ਦੇ ਵਿੱਚ ਜਿਹੜਾ ਸੋਇਆ ਸੋਸ ਨਾਲ ਇਹਨਾਂ ਦੇ ਵਿੱਚ ਰੰਗ ਆਉਂਦਾ ਹੈ ਚਿੱਲੀ ਸੋਸ ਦੇ ਵਿੱਚ ਇਹਨਾਂ ਦਾ ਖੱਟਾਪਨ ਜਿਹਾ ਆਉਂਦਾ ਹੈ ਅਤੇ ਟਮਾਟੋ ਸੋਸ ਦੇ ਨਾਲ ਵੀ ਇਹਨਾਂ ਨਾਲ ਖੱਟਾਪਨ ਅਤੇ ਮਿੱਠਾਪਨ ਵੀ ਆਉਂਦਾ ਹੈ ਅਤੇ ਸੀਜ਼ਨਿੰਗ ਦੇ ਨਾਲ ਇੱਕ ਇੱਕ ਇਹੋ ਜਿਹਾ ਇਹੋ ਜਿਹਾ ਫਲੇਵਰ ਆਉਂਦਾ ਹੈ ਜਾ ਇਹੋ ਜਿਹੀ ਸੁਗੰਧ ਆਉਂਦੀ ਹੈ ਜਿਹਦੇ ਨਾਲ ਇਹ ਇਸਤੇਮਾਲ ਕਰਕੇ ਹੀ ਅਸੀਂ ਨਿਊਡਲ ਜੋ ਕਿ ਇੱਕ ਵਿਦੇਸ਼ੀ ਹੀ ਚੀਜ਼ ਹੈ ਅਤੇ ਇਹ ਵਿਦੇਸ਼ੀ ਚੀਜ਼ ਨੂੰ ਬਣਾਉਣ ਲਈ ਸਾਨੂੰ ਵਿਦੇਸ਼ੀ ਚੀਜ਼ਾਂ ਦਾ ਹੀ ਇਸਤੇਮਾਲ ਕਰਨਾ ਪੈਂਦਾ ਹੈ ਅਤੇ ਮੈਂ ਨਿਊਡਲ ਵਗੈਰਾ ਬਣਾਉਣ ਦੇ ਲਈ ਇਹਨਾਂ ਵਿਦੇਸ਼ੀ ਚੀਜ਼ਾਂ ਦਾ ਹੀ ਇਸਤੇਮਾਲ ਕਰਕੇ ਆਪਣੀ ਸਮੱਗਰੀ ਨਾਲ ਇਹਨਾਂ ਚੀਜ਼ਾਂ ਦਾ ਯੂ ਇਸਤੇਮਾਲ ਕਰਕੇ ਹੀ ਮੈਂ ਨਿਊਡਲ ਬਣਾਏ ਜਿਹਦੇ ਨਾਲ ਕਿ ਮੇਰੇ ਨਿਊਡਲ ਖਾਣ ਦੇ ਵੀ ਜਿਹੜੇ ਚਿੱਟਾ ਨਮਕ ਕਹਿੰਦੇ ਉਹਨੂੰ ਅਜੀਨੋਮੋਟੋ ਕਹਿੰਦੇ ਹਨ ਵਿਦੇਸ਼ਾਂ ਵਿੱਚ ਲੋਕ ਉਸਨੂੰ ਅਜੀਨੋਮੋਟੋ ਕਹਿੰਦੇ ਜਿਨ੍ਹਾਂ ਵਿੱਚ ਖੱਟਾਪਨ ਵੀ ਹੁੰਦਾ ਹੈ ਅਤੇ ਇਹਦੇ ਨਾਲ ਸਾਡਾ ਸਵਾਦ ਵੀ ਵੱਧ ਜਾਂਦਾ ਹੈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਹੀ ਅਸੀਂ ਉਹਨਾਂ ਦੇ ਉਹਨਾਂ ਦਾ ਉਹਨਾਂ ਦਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਉਹਨਾਂ ਦਵਾਰਾ ਬਣਾਈਆਂ ਹੋਈਆਂ ਚੀਜ਼ਾਂ ਹੀ ਬਣਾ ਸਕਦੇ ਹਨ ਕਿਉਂਕਿ ਜੇ ਅਸੀਂ ਕਿਸੇ ਵੀ ਦੇਸ਼ ਦੀ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਉਸ ਦੇਸ਼ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਕੇ ਹੀ ਅਸੀਂ ਉਹਨਾਂ ਦੇ ਖਾਣ ਵਾਲੀਆਂ ਚੀਜ਼ਾਂ ਨੂੰ ਬਣਾ ਸਕਦੇ ਹਨ ਇਸ ਕਰਕੇ ਮੈਂ ਵੀ ਆਪਣੇ ਨੂਡਲ ਵਗੈਰਾ ਬਣਾਉਣ ਦੇ ਵਿੱਚ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ